ਹਾਂਜੀ ਜਿਹੜਾ ਹੈਗਾ ਨਾ ਆਪਣਾ ਸਿਖਲਾਈ ਅਤੇ ਦੌੜ ਦੀ ਤਿਆਰੀ ਦੇ ਵਿੱਚ ਨਾ ਪੋਸ਼ਣ ਅਤੇ ਹਾਈਡਰੇਸ਼ਨ ਦਾ ਨਾ ਬਹੁਤ ਜ਼ਿਆਦਾ ਮਹੱਤਵ ਹੈਗਾ ਇਹ ਨਾ ਸਾਨੂੰ ਊਰਜਾ ਪ੍ਰਦਾਨ ਕਰਦਾ ਹੈਗਾ ਕਸਰਤ ਕਰਨ ਦੇ ਨਾਲ ਜਿਹੜਾ ਸਰੀਰ ਨੂੰ ਊਰਜਾ ਦੀ ਲੋੜ ਹੁੰਦੀ ਹੈ ਇਹ ਸਾਨੂੰ ਭੋਜਨ ਤੋਂ ਮਿਲਦੀ ਆ ਹੈ ਨਾ ਅਤੇ ਉਸ ਤੋਂ ਇਲਾਵਾ ਸਾਡੀਆਂ ਮਾਸ਼ਪੇਸ਼ੀਆਂ ਦੀ ਮਰੰਮਤ ਹੁੰਦੀ ਹੈ ਕਸਰਤ ਕਰਨ ਦੇ ਨਾਲ ਜਿਹੜਾ ਮਾਸਪੇਸ਼ੀਆਂ ਦਾ ਨਾ ਆਪਣਾ ਨੁਕਸਾਨ ਹੁੰਦਾ ਹੈਗਾ ਪ੍ਰੋਟੀਨ ਆ ਜਿਹੜਾ ਮਾਸਪੇਸ਼ੀਆਂ ਦੀ ਮਰੰਮਤ ਕਰਦਾ ਅਤੇ ਉਹਦੇ ਵਿਕਾਸ ਦੇ ਵਿੱਚ ਵਾਧਾ ਵੀ ਕਰਦਾ ਹੈਗਾ ਭਾਈ ਇਮਿਊਨਿਟੀ ਸਿਸਟਮ ਹੁੰਦਾ ਹੈਗਾ ਉਹਨੂੰ ਵੀ ਇਹ ਮਜ਼ਬੂਤ ਬਣਾਉਂਦਾ ਹੈਗਾ ਉਹਦੇ ਨਾਲ ਕੀ ਆਪਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੈਂਗਾ ਜਿਹੜਾ ਹਾਈਡਰੇਸ਼ਨ ਹੈ ਨਾ ਇਹਦੇ ਨਾਲ ਕੀ ਆ ਕਸਰਤ ਕਰਨ ਦੇ ਨਾਲ ਜਿਹੜਾ ਸਰੀਰ ਦੇ ਵਿੱਚੋਂ ਪਾਣੀ ਨਿਕਲ ਜਾਂਦਾ ਹੈਗਾ ਇਸ ਲਈ ਕਸਰਤ ਕਰਨ ਤੋਂ ਪਹਿਲਾਂ ਅਤੇ ਉਹ ਕਸਰਤ ਕਰਦੇ ਕਰਦੇ ਜਿਹੜਾ ਬਾਅਦ ਦੇ ਵਿੱਚ ਵੀ ਸਾਨੂੰ ਬਹੁਤ ਜ਼ਿਆਦਾ ਪਾਣੀ ਪੀਣਾ ਹੀ ਚਾਹੀਦਾ ਲਗਾਤਾਰ ਪਾਣੀ ਪੀਂਦੇ ਰਹਿਣਾ ਚਾਹੀਏ ਅਤੇ ਸਿਖਲਾਈ ਅਤੇ ਦੌੜ ਦੀ ਤਿਆਰੀ ਦੇ ਵਿੱਚ ਹੀ ਸਾਨੂੰ ਕੀ ਕੀ ਖਾਣਾ ਚਾਹੀਦਾ ਇਹ ਚੀਜ਼ਾਂ ਦਾ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈਗਾ ਸਾਨੂੰ ਕਾਰਬੋਹਾਈਡਰੇਟਸ ਵੀ ਵੱਧ ਖਾਣੇ ਚਾਹੀਦੇ ਨੇ ਇਹਦੇ ਵਿਚ ਅਨਾਜ ਫਲ ਸਬਜ਼ੀਆਂ ਅਤੇ ਦਾਲਾਂ ਪਾਈਆਂ ਜਾਂਦੀਆਂ ਨੇ ਪ੍ਰੋਟੀਨ ਵੀ ਸਾਨੂੰ ਬਹੁਤ ਜ਼ਰੂਰੀ ਹੈ ਸਾਡੇ ਲਈ ਮੀਟ ਅੰਡੇ ਦੁੱਧ ਦਾਲਾਂ ਹੈ ਨਾ ਅਤੇ ਚਰਬੀ ਦੇ ਲਈ ਸਾਨੂੰ ਨਟਸ ਬੀਜਾਂ ਦੇ ਵਿੱਚ ਮਿਲਦੇ ਗੇ ਇਹ ਸਾਰੀਆਂ ਚੀਜ਼ਾਂ ਸਾਨੂੰ ਕਰਨੀਆਂ ਖਾਣੀਆਂ ਚਾਹੀਦੀਆਂ ਹੈਗੀਆਂ ਅਤੇ ਕਸਰਤ ਤੋਂ ਪਹਿਲਾਂ ਦੇ ਦੇ ਦੌਰਾਨ ਦੇ ਵਿੱਚ ਸਾਨੂੰ ਕੀ ਖਾਣਾ ਚਾਹੀਦਾ ਹੈਗਾ ਇਹ ਵੀ ਕੀ ਹੈਗਾ ਕਸਰਤ ਕਰਨ ਤੋਂ ਪਹਿਲਾਂ ਤਾਂ ਕਸਰਤ ਕਰਨ ਤੋਂ ਦੋ ਘੰਟੇ ਪਹਿਲਾਂ ਇੱਕ ਸੰਤੁਲਿਤ ਭੋਜਨ ਖਾਣਾ ਆਪਾਂ ਠੀਕ ਹੈ ਜੀ ਕਸਰਤ ਕਰਨ ਦੇ ਜੇ ਦੌਰਾਨ ਹਰ ਪੰਦਰ੍ਹਾਂ ਵੀਹ ਮਿੰਟਾਂ ਦੇ ਵਿੱਚ ਸਾਨੂੰ ਪਾਣੀ ਵੀ ਪੀਣਾ ਚਾਹੀਦਾ ਕਾਰਬੋਹਾਈਡਰੇਟਸ ਖਾਣੇ ਚਾਹੀਦੇ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਕਿ ਆਪਾਂ ਕਰਦੀ ਆਂਗੇ ਕਸਰਤ ਠੀਕ ਆ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਹੈਗੀਆਂ ਅਤੇ ਉਹਦੇ ਨਾਲ ਕੀ ਜਿਹੜਾ ਸਾਡਾ ਸਰੀਰ ਆ ਠੀਕ ਰਹਿੰਦਾ ਹੈਗਾ ਸਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਧੰਨਵਾਦ ਜੀ